ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਆਪਣੇ ਹਰਪ੍ਰੀਤ ਟੂਰ ਟਰੈਵਲ ਤੋਂ ਬੋਲਦੇ ਪਏ ਜੀ ਭਾਅ ਜੀ ਮੇਰੇ ਦੋਸਤ ਨੇ ਨੰਬਰ ਦਿੱਤਾ ਜੀ ਤੁਹਾਡਾ ਪਿਛਲੇ ਸਾਲ ਗਏ ਗਿਆ ਸੀ ਇੱਥੋਂ ਆਪਣੇ ਥਾਈਲੈਂਡ ਦਾ ਟੂਰ ਟੂਰ ਗਏ ਸੀ ਇੱਥੋਂ ਕਹਿੰਦਾ ਵੀ ਉਹਨਾਂ ਨੂੰ ਹਰਪ੍ਰੀਤ ਟੁ ਟੂਰ ਟਰੈਵਲ ਨੂੰ ਕਹਿੰਦਾ ਪੁੱਛ ਲਓ ਕਹਿੰਦਾ ਉਹ ਲੈ ਕੇ ਜਾਂਦੇ ਆ ਫਿਰ ਮੈਨੂੰ ਦੱਸੋ ਕਿ ਕਿਹੜੀ ਕਿਹੜੀ ਥਾਵਾਂ 'ਤੇ ਘੁੰਮਾਉਗੇ ਤੁਸੀਂ ਮੈਨੂੰ ਫਿਰ ਭਾਅ ਜੀ ਉੱਥੇ ਆਪਣੇ ਥਾਈਲੈਂਡ ਜਾਣਾ ਭਾਅ ਜੀ ਆਪਾਂ ਇਹ ਆਪਾਂ ਦੂਜੇ ਜਾਣਾ ਚਾਹੁੰਦੇ ਹਾਂ ਫੁੱਲ ਜੀ

ਅੱਛਾ ਰੈਸਟੋਰੈਂਟ ਕਿੱਦਾਂ ਉੱਥੇ ਵਧੀਆ ਰੈਸਟੋਰੈਂਟ ਆ ਬੀਚ ਬੂਚ 'ਤੇ ਕਿੱਦਾਂ ਅੱਛਾ ਭਾਅ ਜੀ ਠੀਕ ਹੈ ਭਾਅ ਜੀ ਕੋਈ ਨਹੀਂ ਮੈਂ ਨਾ ਸਲਾਹ ਕਰਕੇ ਸਵੇਰ ਨੂੰ ਫੋਨ ਕਰੂੰਗਾ ਭਾਅ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ